ਸਤਿ ਸ਼੍ਰੀ ਅਕਾਲ ਜੀ ਮੈਂ ਜਿੱਦਾਂ ਹੀ ਕੰਮ ਤੋਂ ਵਿਹਲੀ ਹੁੰਦੀ ਹਾਂ ਤਾਂ ਮੈਂ ਆ ਕੇ ਸ਼ਾਮ ਨੂੰ ਛੇ ਸੱਤ ਵਜੇ ਟੀ ਵੀ ਅੱਗੇ ਬੈਠ ਜਾਂਦੀ ਹਾਂ ਉਸਦੇ ਉੱਪਰ ਸੰਜੀਵ ਕਪੂਰ ਜੀ ਦਾ ਸ਼ੋ ਆਉਂਦਾ ਹੈ ਜੋ ਕਿ ਬੜਾ ਹੀ ਵਧੀਆ ਹੈ ਜਿਸ ਤੋਂ ਸਾਨੂੰ ਬੜੇ ਹੀ ਸਵਾਦਿਸ਼ਟ ਅਤੇ ਸਿਹਤਮੰਦ ਖਾਣੇ ਬਣਾਉਣ ਦੀ ਰੈਸਪੀ ਆ ਸਕਦੀ ਹੈ ਅਤੇ ਮੈਂ ਉਸਨੂੰ ਰੋਜ਼ ਦੇਖਦੀ ਹਾਂ ਮੇਰੀ ਸਭ ਤੋਂ ਵਧੀਆ ਰੈਸਪੀ ਉਸਦੇ ਉੱਪਰ ਗੋਭੀ ਦੀ ਹੈ ਜੋ ਕਿ ਬੜੇ ਹੀ ਸਵਾਦਿਸ਼ਟ ਅਤੇ ਸਿਹਤਮੰਦ ਬਣਾਈ ਬਣਾਉਣੀ ਸਿਖਾਈ ਹੈ ਉਹਨਾਂ ਨੇ ਸਭ ਤੋਂ ਪਹਿਲਾਂ ਉਹ ਗੋਭੀ ਨੂੰ ਉਬਾਲਦੇ ਹਨ ਉਬਾਲ ਕੇ ਉਸ ਵਿੱਚ ਜਿੰਨੇ ਵੀ ਕੀਟਾਣੂ ਕੀਟਨਾਸ਼ਕ ਚੀਜ਼ਾਂ ਹੁੰਦੀਆਂ ਹਨ ਉਸਨੂੰ ਖ਼ਤਮ ਕਰਦੇ ਹਨ ਅਤੇ ਉਸ ਤੋਂ ਬਾਅਦ ਉਸਨੂੰ ਤਲ ਕੇ ਬੜੇ ਹੀ ਵਧੀਆ ਤਰੀਕੇ ਨਾਲ ਬਣਾਉਂਦੇ ਹਨ ਮੇਰੇ ਘਰ ਦਾ ਮਾਹੌਲ ਵੀ ਬੜਾ ਵਧੀਆ ਹੈ ਕਿਉਂਕਿ ਸਵਾਦਿਸ਼ਟ ਖਾਣੇ ਨਾਲ ਸਾਰੇ ਤੰਦਰੁਸਤ ਰਹਿੰਦੇ ਹਨ ਅਤੇ ਮੈਂ ਕਈ ਵਾਰ ਟੀ ਵੀ ਦੇ ਨਾਲ ਨਾਲ ਯੂਟਿਊਬ ਨੂੰ ਵੀ ਵਰਤਦੀ ਹਾਂ ਜਿਸ ਦੇ ਉੱਪਰ ਮੈਂ ਬਾਰਤ ਕਿਚਨ ਕਵਿਤਾ ਕਿਚਨ ਬਰਤਾਜ ਕਿਚਨ ਇਹਨਾਂ ਤੋਂ ਬੜੀਆਂ ਹੀ ਵਧੀਆ ਚੀਜ਼ਾਂ ਸਿੱਖਦੀ ਹਾਂ ਅਤੇ ਸਵਾਦਿਸ਼ਟ ਦੇ ਸਿਹਤਮੰਦ ਚੀਜ਼ਾਂ ਬਣਾਉਣੀਆਂ ਆ ਆਉਂਦੀਆਂ ਹਨ ਮੈਨੂੰ ਧੰਨਵਾਦ